ਮੇਰੇ ਕੋਲ ਔਪੋ ਐੱਫ ਨਾਈਨ ਸਮਾਰਟਫੋਨ ਹੈ ਅਤੇ ਅੱਜ ਕੱਲ੍ਹ ਇੰਟਰਨੈੱਟ ਨੇ ਇੰਨੀ ਤਰੱਕੀ ਕਰ ਲਈ ਬੈਂਕ ਜਾਣ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ ਤਾਂ ਆਪਾਂ ਨੂੰ ਬੈਂਕ ਦਾ ਬੈਲੇਂਸ ਘਰ ਬੈਠੇ ਹੀ ਪਤਾ ਚੱਲ ਜਾਂਦਾ ਹੈ ਕੋਈ ਗੂਗਲ ਪੇਅ ਰਾਹੀਂ ਕਿਸੇ ਨੂੰ ਪੇਮੈਂਟ ਕਰਨੀ ਹੋਵੇ ਜਾਂ ਕੋਈ ਚੀਜ਼ ਖ਼ਰੀਦਣੀ ਹੋਵੇ ਤਾਂ ਆਪਾਂ ਨੂੰ ਘਰ ਬੈਠੇ ਪੇਮੈਂਟ ਕਰਕੇ ਤਾਂ ਚੀਜ਼ ਆਪਣੇ ਘਰ ਆ ਜਾਂਦੀ ਹੈ ਜਿਕਣ ਹੁਣ ਆਪਾਂ ਨੇ ਕਿਤੇ ਘੁੰਮਣ ਜਾਣਾ ਤਾਂ ਆਪਾਂ ਨੇ ਕੋਈ ਟਿਕਟ ਬੁੱਕ ਕਰਨੀ ਹੈ ਕਿਤੇ ਵੀ ਜਾਣ ਲਈ ਤਾਂ ਆਪਾਂ ਘਰ ਬੈਠੇ ਟਿਕਟ ਬੁੱਕ ਬੁੱਕ ਕਰ ਸਕਦੇ ਹਾਂ ਵੀ ਸਾਡੀ ਟ੍ਰੇਨ ਅੱਜ ਦੀ ਕਦੋਂ ਦੀ ਹੈਗੀ ਆ ਕਦੋਂ ਦੀ ਨਹੀਂ ਹੈਗੀ ਤਾਂ ਆਪਾਂ ਨੂੰ ਸਾਰਾ ਕੁਛ ਪਤਾ ਚਲ ਜਾਂਦਾ ਅਤੇ ਆਪਣੀ ਕਾਫੀ ਜ਼ਿਆਦਾ ਸੁਵਿਧਾ ਮਿਲਣ ਲੱਗ ਗਈ ਇੰਟਰਨੈੱਟ ਰਾਹੀਂ ਅਤੇ ਕਾਫੀ ਜ਼ਿਆਦਾ ਤਰੱਕੀ ਹੋ ਗਈ